ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜਨਾਬ ਜੀ ਅਤੇ ਅਸੀਂ ਕੁੱਝ ਦਿਨਾਂ 'ਚ ਇੱਥੇ ਪੰਜਾਬ ਦੇ ਵਿੱਚ ਘੁੰਮਣ ਦੇ ਲਈ ਆਉਣਾ ਅਤੇ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਪ੍ਰਬੰਧ ਗੱਡੀ ਦੇ ਜਾਂ ਕਿਹੜੀ ਕਿਹੜੀ ਜਗ੍ਹਾ ਆਪਾਂ ਘੁੰਮ ਸਕਦੇ ਹਾਂ ਉਹ ਕਰ ਸਕਦੇ ਹਾਂ ਜੀ ਠੀਕ ਹੈ ਜੀ ਕਿੱਥੇ ਕਿੱਥੇ ਘੁੰਮਿਆ ਜਾ ਸਕਦਾ ਜੀ ਠੀਕ ਹੈ ਜੀ ਠੀਕ ਹੈ ਪ੍ਰਬੰਧ ਵਧੀਆ ਰਹੇਗਾ ਜੀ ਹਾਂਜੀ ਠੀਕ ਠੀਕ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ